ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕਿਵੇਂ ਹੋ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਹੋਰ ਘਰ ਪਰਿਵਾਰ ਕਿਵੇਂ ਠੀਕ ਹੈ ਜੀ ਅੱਛਾ ਜੀ ਚਲੋ ਵਧੀਆ ਹੋਰ ਦੱਸੋ ਬੱਚੇ ਕਿੱਥੇ ਲਾਤੇ ਆ ਸਕੂਲ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਮੈਂ ਵੀ ਦੋ ਤਿੰਨ ਸਕੂਲ ਦੇਖ ਕੇ ਆਈ ਸੀ ਬੈਸਟ ਸਕੂਲ ਤਾਂ ਵੈਸੇ ਇੱਕ ਤਾਂ ਐੱਸ ਡੀ ਸਕੂਲ ਸੀ ਵਧੀਆ ਉਹਦੇ ਵਿੱਚ ਫੀਸ ਵੀ ਜ਼ਿਆਦਾ ਸੀ ਅਤੇ ਮਤਲਬ ਹੈ ਨਾ ਅ ਦੂਰ ਵੀ ਠੀਕ ਸੀਗਾ ਅਤੇ ਪੜ੍ਹਾਈ ਵੀ ਵਧੀਆ ਸੀਗੀ ਅਤੇ ਬੱਸ ਫਿਰ ਸਾਨੂੰ ਫੀਸ ਦਾ ਥੋੜ੍ਹਾ ਜਿਹਾ ਪ੍ਰੋਬਲਮ ਹੋ ਗਈ ਇਸ ਲਈ ਮੈਨੂੰ ਲੋਟ ਨਹੀਂ ਲੱਗਿਆ ਅਤੇ ਇੱਕ ਇੱਕ ਸਕੂਲ ਮੈਂ ਹੋਰ ਗਈ ਸੀ ਇੱਥੇ ਆਪਣੀ ਅ ਸੈਕਿੰਡ ਹਾਰਟ ਜੀ ਉਹ ਵੀ ਮੈਨੂੰ ਠੀਕ ਲੱਗਿਆ ਬਟ ਉਹ ਦੂਰ ਵਾਹਲੀ ਆ ਉਹਦੇ ਵਿੱਚ ਪੜ੍ਹਾਈ ਵੀ ਵਧੀਆ ਸੀ ਉਹ ਥੋੜ੍ਹਾ ਜਿਹਾ ਦੂਰ ਸੀ ਅਤੇ ਸਾਨੂੰ ਲੋਟ ਨਹੀਂ ਪੈਂਦਾ ਖਰਚਾ ਵੀ ਜ਼ਿਆਦਾ ਪੈਂਦਾ ਹਾਂਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂ ਕੋਈ ਨਾ ਜੀ ਫਿਰ ਆਪਾਂ ਹੈ ਨਾ ਬੈਸਟ ਸਕੂਲ ਦੇਖ ਲਾਂਗੇ ਮਤਲਬ ਵਧੀਆ ਕਿਹੜਾ ਗਾ ਵੀ ਹੈ ਨਾ ਬਰਨਾਲੇ 'ਚ ਤਾਂ ਬਹੁਤ ਵਧੀਆ ਸਕੂਲ ਨੇਗੇ ਅਤੇ ਹੈ ਨਾ ਟਾਈਮ ਵੀ ਹੈ ਨਾ ਉਹ ਦੇਖ ਲਾਂਗੇ ਆਪਾਂ ਮਤਲਬ ਕਦੋਂ ਜਾਣਾ ਗਾ ਮਤਲਬ ਆਪਾਂ ਨਾਲੇ ਬੱਚਿਆਂ ਨੂੰ ਨਾਲ ਲੈ ਚੱਲਾਂਗੇ ਵੀ ਹੈ ਨਾ ਸਕੂਲ ਜੇ ਉਹਨਾਂ ਨੂੰ ਵਧੀਆ ਲੱਗਿਆ ਤਾਂ ਲੱਗ ਜਾਣਗੇ ਅੱਛਾ ਜੀ ਤੁਸੀਂ ਹੋਰ ਕਿਹੜਾ ਸਕੂਲ ਸੀਗਾ ਜੀ ਅੱਛਾ ਜੀ ਉਹ ਬੈਸਟ ਸੀ ਜੀ ਉਹ ਅੱਛਾ ਜੀ ਅੱਛਾ ਜੀ ਕੋਈ ਨਾ ਜੀ ਫਿਰ ਆਪਾਂ ਕੱਲ੍ਹ ਨੂੰ ਮੋਰਨਿੰਗ ਚੱਲਾਂਗੇ ਜੀ ਭੈਣ ਜੀ ਠੀਕ ਹੈ ਜੀ ਉੱਥੇ ਆਪਾਂ ਦੇਖ ਆਵਾਂਗੇ ਕਿਹੜਾ ਆਪਾਂ ਨੂੰ ਬੈਸਟ ਸਕੂਲ ਵਧੀਆ ਲੱਗਦਾ ਵੀ ਫਿਰ ਆਪਾਂ ਵੱਗ ਚੱਲਾਂਗੇ ਆ ਮੈਂ ਸਵੇਰੇ ਆ ਜਾਉਂਗੀ ਸਕੂਟਰੀ ਚੱਕ ਕੇ ਠੀਕ ਹੈ ਜੀ ਟਾਈਮ ਤੁਸੀਂ ਟਾਈਮ ਦੱਸ ਦਿਓ ਮੈਨੂੰ ਕਿੰਨੇ ਵਜੇ ਫਰੀ ਹੋ ਜੋਗੇ ਜੀ ਸਾਢੇ ਕੁ ਅੱਠ ਵਜੇ ਠੀਕ ਐ ਹੈ ਚੰਗਾ ਜੀ ਓਕੇ ਜੀ ਠੀਕ ਠੀਕ ਹੈ